ਹੈਲੋ ਹਾਂਜੀ ਐਨੀ ਬੇਕਰਸ ਤੋਂ ਬੋਲ ਰਹੇ ਜੀ ਹਾਂਜੀ ਮੈਂ ਕੁਛ ਕੇਕ ਬਾਰੇ ਪਤਾ ਕਰਨਾ ਸੀ ਹਾਂ ਹਾਂਜੀ ਪਹਿਲਾਂ ਮੈਨੂੰ ਦੱਸੋ ਤੁਸੀਂ ਕਿਹੜੀ ਵਰਾਈਟੀਆਂ ਨੇ ਹਾਂਜੀ ਹਾਂਜੀ ਠੀਕ ਹੈ ਸਟੋਬੇਰੀ ਵਾਲਾ ਅੱਛਾ ਜੀ ਹਾਂਜੀ ਹਾਂਜੀ ਠੀਕ ਹੈ ਅਤੇ ਕੀ ਨਾਮ ਮਤਲਬ ਐੱਗਲੈੱਸ ਹੁੰਦੇ ਹੈ ਜਾਂ ਐੱਗ ਵਗੈਰਾ ਵੀ ਯੂਜ ਕਰਦੇ ਆ ਅੱਛਾ ਅੱਛਾ ਜੀ ਠੀਕ ਹੈ ਮਤਲਬ ਤੁਸੀਂ ਇੱਕ ਕੇਕ ਓਡਰ 'ਤੇ ਤਿਆਰ ਕਰ ਦਿਓ ਹਾਂਜੀ ਤੁਸੀਂ ਚੌਕਲੇਟ ਵਾਲਾ ਰੈਡੀ ਕਰਵਾ ਦਿਓ ਨਹੀਂ ਕੀ ਨਾਮ ਬਰਡੇ ਦਾ ਹੈ ਹਾਂਜੀ ਅਤੇ ਕੀ ਨਾਮ ਦਿਓ ਪੋਂ ਦੋ ਦੋ ਪੌਂਡ ਦਾ ਤਿਆਰ ਕਰਵਾ ਦਿਓ ਹਾਂਜੀ ਅਤੇ ਤੁਸੀਂ ਲੇਅਰ ਵੀ ਬਣਵਾ ਦੋਂਗੇ ਦੋ ਜ ਦੋ ਜਾਂ ਤਿੰਨ ਲੇਅਰ ਬਨਵਾਨੀ ਹੋਵੇ ਠੀਕ ਹੈ ਫੇਰ ਤੁਸੀਂ ਇੱਦਾਂ ਕਰੋ ਦਿਓ ਲੇਅਰ ਦਾ ਕੇਕ ਬਣਵਾ ਦੇਣਾ ਚੌਕਲੇਟ ਨਹੀਂ ਵੱਡੇ ਵੱਡੇ ਦਾ ਹੀ ਹੈ ਬਰਡੇ ਹਾਂਜੀ ਅਤੇ ਤੁਸੀਂ ਦਿਓ ਲੇਅਰ ਦਾ ਤਿਆਰ ਕਰਵਾ ਦਿਓ ਔਰ ਉੱਪਰ ਥੋੜ੍ਹੀ ਜਿਹੀ ਡੀਸੈਂਟ ਜੀ ਮਤਲਬ ਰੱਖਣੀ ਹੈ ਡੈਕੋਰੇਸ਼ਨ ਜਾਂ ਜਿਹੜੀ ਵੀ ਕੁਛ ਹੁੰਦਾ ਉੱਪਰ ਹਾਂਜੀ ਅਤੇ ਤੁਸੀਂ ਹੈਪੀ ਬਰਡੇ ਲਿਖ ਕੇ ਹੈਪੀ ਬਰਡੇ ਸਾਹਿਲ ਲਿਖ ਦੇਣਾ ਹਾਂਜੀ ਹੈਪੀ ਬਰਡੇ ਸਾਹਿਲ ਲਿਖ ਦੇਣਾ ਹੂੰ ਅਤੇ ਉੱਪਰ ਉਹ ਜਿਹੜੇ ਅੱਜ ਕੱਲ੍ਹ ਚੱਲੇ ਹੋਏ ਹੈ ਥੋੜ੍ਹੇ ਜਿਹੇ ਵੈਫਰ ਜਿਹੇ ਲਗਾਉਂਦੇ ਹੈ ਜਿਵੇਂ ਉਹ ਉਹਦੇ ਨਾਲ ਹਾਂ ਉਹਦੇ ਨਾਲ ਹਾਂ ਉਹਦੇ ਵਈ ਵਧੀਆ ਬਣਾ ਦਿਓ ਕੇਕ ਅਤੇ ਕਿੰਨੀ ਕੁ ਦੇਰ' ਚ ਤਿਆਰ ਹੋ ਜਾਂਦਾ ਅੱਛਾ ਅਤੇ ਕਿੰਨ ਕਿਵੇਂ ਕੀ ਰੇਟ ਹੈ ਇੱਕ ਪੌਂਡ ਦਾ ਜਿਵੇਂ ਦੋ ਪੌਂਡ ਦਾ ਜਾਂ

ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਫੇਰ ਤੁਸੀਂ ਕਰਵਾ ਦਿਓ ਰੈਡੀ ਹਾਂਜੀ ਹਾਂ ਤੁਸੀਂ ਹਾਂ ਬੈਲੂਨ ਭੇਜ ਦਿਓ ਅਤੇ ਨਾਲ ਕੈਂਡਲਸ ਭੇਜ ਦਿਓ ਹਾਂਜੀ ਟਵੈਂਟੀ ਵਾਲੀ ਭੇਜ ਦਿਓ ਟਵੈਂਟੀ ਏਜ ਦੀ ਜਿਵੇਂ ਟਵੈਂਟੀ ਦੇ ਹੈ ਉਹ ਠੀਕ ਹੈ ਹਾਂਜੀ ਠੀਕ ਹੈ ਅਤੇ ਮੈਂ ਪੇ ਨਹੀਂ ਨਹੀਂ ਬਸ ਬਸ ਨਹੀਂ ਬਸ ਚੋਕ ਕੀ ਨਾਮ ਚੌਕਲੇਟ ਕੇਕ ਚੌਕਲੇਟ ਫਲੇਵਰ ਦਾ ਕੈਂਡਲਸ ਭੇਜ ਦਿਓ ਬਸ ਨਹੀਂ ਨਹੀਂ ਨਹੀਂ ਜੀ ਨਹੀਂ ਬਸ ਹੂੰ ਅਤੇ ਪੈਸੇ ਮੈਂ ਤੁਹਾਨੂੰ ਔਨਲਾਈਨ ਕਰ ਦਿੰਦੀ ਹਾਂ ਹੂੰ ਅਤੇ ਕਿੰਨੀ ਦੇਰ 'ਚ ਤਿਆਰ ਹੋਜੇਗਾ ਹਾਂਜੀ ਠੀਕ ਹੈ ਮੈਂ ਐਡਰੈਸ ਸੈਂਡ ਕਰ ਦਿੰਦੀ ਹਾਂ ਤੁਹਾਨੂੰ ਓਕੇ ਓਕੇ ਜੀ ਥੈਂਕ ਯੂ